ਸ਼੍ਰੀ ਫਤਿਹਗੜ੍ਹ ਸਾਹਿਬ ਇਹ ਬਹੁਤ ਦੁੱਖ ਦਾਇਕ ਸ ਧਰਮ ਸਥਾਨ ਹੈ ਇੱਥੇ ਸ਼੍ਰੀ ਗੁਰੂ ਗੋ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੋ ਸੱਤ ਸਾਲ ਅਤੇ ਨੌਂ ਸਾਲ ਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਬਾਅਦ ਦੇ ਵਿੱਚ ਗੁਰੂ ਇਹਨਾਂ ਨੂੰ ਜੋਤੀ ਸਰੂਪ ਗੁਰਦੁਆਰਾ ਸਾਹਿਬ ਲਿਆ ਕੇ ਸੰਸਕਾਰ ਕੀਤਾ ਸੀ ਪਰ ਉੱਥੇ ਬਹੁਤ ਮਹਿੰਗੀ ਜਗ੍ਹਾ ਖਰੀਦਣੀ ਪਈ ਜੋ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਖਰੀਦੀ ਗਈ ਸੀ ਅਤੇ ਉਸ ਤੋਂ ਨਾਲ ਲੱਗਦਾ ਹੀ ਇਲਾਕਾ ਵੱਡਾ ਸਾਹਿਬਜ਼ਾਦੇ ਕਿਵੇਂ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸੀ ਅਤੇ ਉਦੋਂ ਅੱਗੇ ਅਨੰਦਪੁਰ ਸਾਹਿਬ ਆ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਕਿਵੇਂ ਨ ਸ਼੍ਰੀ ਹਰਿਮੰਦਰ ਸਾਹਿਬ ਅੰਬਰਸਰ ਸਾਹਿਬ ਆ ਉਹਨਾਂ ਦੇ ਵੀ ਦਰਸ਼ਨ ਕਰਨ ਲਈ ਲੋਕ ਹਰੇਕ ਥਾਂ ਤੋਂ ਆਉਂਦੇ ਹਨ ਤਾਂ ਬਾਘਾ ਬਾਡਰ ਵੀ ਉੱਥੇ ਨੇੜੇ ਲੱਗਦਾ ਹੈ ਉੱਥੇ ਵੀ ਘੁੰਮ ਕੇ ਆਉਂਦੇ ਹਨ